ਮੇਰਾ ਨਾਮ ਰਾਹੁਲ ਹੈ ਮੈਂ ਇਲੈਕਟ੍ਰੋਨਿਕ ਉਪਕਰਨਾਂ ਵਿੱਚ ਅਪਗ੍ਰੇਡ ਕਰ ਰਿਹਾ ਹਾਂ ਮੇਰੇ ਕੋਲ ਇੱਕ ਦਫ਼ਤਰ ਹੈ ਜਿਸ ਵਿੱਚ ਮੈਂ ਬਹੁਤ ਸਾਰੇ ਨਵੇਂ ਕੰਪਿਊਟਰ ਅਤੇ ਪ੍ਰਿੰਟਰ ਖਰੀਦ ਕੇ ਰੱਖ ਲਏ ਹਨ ਪਰ ਉਸ ਵਿੱਚ ਬਹੁਤ ਸਾਰੇ ਕੰਪਿਊਟਰ ਪੁਰਾਣੇ ਹਨ ਅਤੇ ਕੁਛ ਚੱਲ ਨਹੀਂ ਰਹੇ ਜਿਸ ਵਿੱਚ ਪ੍ਰਿੰਟਰਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਇਲੈਕਟ੍ਰੋਨਿਕਾਂ ਰਹਿੰਦ ਖੂੰਹਦ ਦੀ ਜ਼ਿੰਮੇਵਾਰੀ ਨੂੰ ਨਿਪਟਾਉਣ ਲਈ ਮੈਂ ਇਸ ਰਹਿੰਦ ਖੂੰਹਦ ਨੂੰ ਚੁੱਕਣ ਦਾ ਸਮਾਂ ਏ ਬਣਾਇਆ ਹੈ ਇਸ ਲਈ ਮੈਂ ਤੁਹਾਨੂੰ ਕਾਲ ਕੀਤੀ ਹੈ ਨਿਰਧਾਰਿਤ ਕਰਨ ਲਈ ਰਹਿੰਦ ਖੂੰਹਦ ਪ੍ਰਬੰਧ ਕੰਪਣੀ ਨੂੰ ਕੌਲ ਕੀਤੀ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਨਿਪਟਾ ਸਕਦੇ ਹੋ ਤਾਂ ਮੈਂ ਆਪਣੇ ਓਫਿਸ ਵਿੱਚ ਨਵੇਂ ਕੰਪਿਊਟਰਾਂ ਨੂੰ ਚਾਲੂ ਕਰ ਸਕਾਂ ਮੈਨੂੰ ਇੰਨਾ ਜ਼ਰੂਰ ਦੱਸਿਆ ਜਾਵੇ ਕਿ ਇਸ ਦਾ ਕੋਈ ਫੀਸ ਤਾਂ ਨਹੀਂ ਜੇਕਰ ਫੀਸ ਹੈ ਤਾਂ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਜਾਵੇ ਬਾਕੀ ਕੰਪਿਊਟਰਾਂ ਨੂੰ ਚੁੱਕਣ ਅਤੇ ਨਿਪਟਾਉਣ ਲਈ ਜਿੰਨਾ ਕਿੰਨਾ ਸਮਾਂ ਲੱਗੇਗਾ ਉਸ ਬਾਰੇ ਮੈਨੂੰ ਵਿਸਥਾਰ ਵਿੱਚ ਦੱਸਿਆ ਜਾਵੇ ਬਾਕੀ ਤੁਹਾਡਾ ਧੰਨਵਾਦ